ਹਾਂਜੀ ਮੈਂ ਸੋਸ਼ਲ ਮੀਡੀਆ 'ਤੇ ਆਪਣੀਆਂ ਤਸਵੀਰਾਂ ਅਪਲੋਡ ਕਰਦਾ ਰਹਿੰਦਾ ਜੀ ਜਿਵੇਂ ਕਿ ਆਪਣਾ ਔਨਲਾਈਨ ਪਲੈਟਫੋਮ ਹੋ ਗਿਆ ਇੰਸਟਾਗ੍ਰਾਮ ਹੋ ਗਿਆ ਫੇਸਬੁੱਕ ਹੋ ਗਿਆ ਟਵਿੱਟਰ 'ਤੇ ਹੋ ਗਿਆ ਅਤੇ ਆਪਣਾ ਸਨੈਪਚੈਟ ਇਹਨਾਂ ਸਾਰਿਆਂ ਪਲੈਟਫੋਮਾਂ 'ਤੇ ਮੈਂ ਆਪਣੀਆਂ ਤਸਵੀਰਾਂ ਸ਼ੇਅਰ ਕਰਦਾ ਰਹਿੰਦਾ ਜੀ